ਮੇਰੇ ਖੇਤਰ ਵਿੱਚ ਇੱਕ ਸਵ ਇੱਕ ਸਕੂਲ ਹੈ ਜਿੱਥੇ ਅਸੀਂ ਸ ਸਾਡੀ ਕ੍ਰਿਕੇਟ ਅਕੈਡਮੀ ਹੁੰਦੀ ਹੈ ਤੇ ਮੈਂ ਵੀ ਕ੍ਰਿਕਟ ਅਕੈਡਮੀ ਵਿੱਚ ਹੀ ਜਾਂਦਾ ਹਾਂ ਅਤੇ ਉੱਥੇ ਸਕੂਲ ਤੋਂ ਬਾਅਦ ਸਾਡੇ ਕੋਚ ਆ ਕੇ ਸਾਡੀ ਅਕੈਡਮੀ ਲੈਂਦੇ ਹਨ ਅਤੇ ਉਹ ਬਹੁਤ ਵਧੀਆ ਸਮਾਂ ਹੁੰਦਾ ਹੈ ਤਿੰਨ ਤੋਂ ਚਾਰ ਘੰਟੇ ਸਾਡੇ ਕੋਚ ਬਹੁਤ ਮਿਹਨਤ ਕਰਦੇ ਨੇ ਸਾਡੇ ਉੱਤੇ ਅਤੇ ਜੇ ਅਸੀਂ ਕੁਛ ਬਣ ਜਾਈਏ ਉੱਥੇ ਇੱਕ ਨੈਟ ਇੱਕ ਬੈਟਿੰਗ ਨੈਟਸ ਨੇ ਪ੍ਰੈਕਟਿਸ ਲਈ ਇੱਕ ਗਰਾਉਂਡ ਹੈ ਬਹੁਤ ਵੱਡਾ ਸਾਡੇ ਫਿੱਟਨੈੱਸ ਲਈ ਕਾਫ਼ੀ ਸਮਾਨ ਹੈ ਅਤੇ ਸਾਰੀ ਈਕੋ ਕਲੱਬ ਐਕਟੀਵਿਟੀਜ ਵੀ ਹੁੰਦੀਆਂ ਨੇ ਉੱਥੇ ਬਹੁਤ ਵੱਡਾ ਗਰਾਉਂਡ ਸਾਨੂੰ ਸਾਰੀ ਸਹੂਲਤਾਂ ਮਿਲਦੀਆਂ ਨੇ ਉੱਥੇ ਅਤੇ ਉੱਥੇ ਕਾਫ਼ੀ ਕੁਛ ਹੋ ਸਕਦਾ ਹੈ ਜਿਵੇਂ ਕਿ ਬਹੁਤ ਕੁਛ ਹੋ ਸਕਦਾ ਹੈ ਜਿਵੇਂ ਕਿ ਅਸੀਂ ਖੇਡ ਸਕਦੇ ਹਨ ਅਸੀਂ ਸਭ ਕੁਛ ਕਰ ਸਕਦੇ ਹਨ ਉੱਥੇ ਕ੍ਰਿਕੇਟ ਖੇਡ ਸਕਦੇ ਹਨ ਕੇ ਸਪੋਰਟਸ ਕਲੱਬ ਸਥਿੱਤ ਹੈ ਕਿ ਤੁਸੀਂ ਨਾਮ ਅਤੇ ਉੱਥੇ ਉਪਲੱਬਧ ਸਹੂਲਤਾਂ ਦਾ ਜ਼ਿਕਰ ਕਰ ਸਕਦੇ ਹੋ